ਪੰਜਾਬ ਵਿੱਚ ਟਰਾਂਸਪੋਰਟੇਸ਼ਨ ਤੇ ਬਹੁਤ ਵਰਕ ਹੋਇਆ ਅਵ ਕਹਿ ਦਈਏ ਵਿਕਾਸ ਹੋਇਆ ਹੁਣ ਤੁਸੀਂ ਦੇਖੋ ਪੰਜਾਬ ਦੇ ਸਾਰੇ ਹੀ ਸ਼ਹਿਰਾਂ ਨੂੰ ਹਾਈਵੇ ਨਾਲ ਜੋੜਿਆ ਗਿਆ ਨਵੀਆਂ ਸੜਕਾਂ ਬਣ ਗਈਆਂ ਭੀੜ ਭਾੜ ਇਲਾਕਿਆਂ ਚ ਪੁੱਲ ਵੀ ਬਣ ਗਏ ਹਨ ਲੁਧਿਆਣੇ ਵਰਗੇ ਸ਼ਹਿਰਾਂ ਵਿੱਚ ਜਿਆਦਾ ਟਰੈਫਿਕ ਦੀ ਸਮੱਸਿਆ ਹੋਣ ਕਰਕੇ ਉਥੇ ਪੋਲ ਕਿੰਨੇ ਬਣ ਗਏ ਹਨ ਇਸ ਨਾਲ ਟਰਾਂ ਜਿਸ ਨਾਲ ਟਰਾਂਸਪੋਰਟੇਸ਼ਨ ਸੌਖਾ ਹੋ ਗਿਆ ਹੈ ਤੇ ਇਸ ਦੇ ਨਾਲ ਹੀ ਡਿਜੀਟਲ ਕਨੈਕਟੀਵਿਟੀ ਵਿੱਚ ਵੀ ਬਹੁਤ ਵਧੀਆ ਅੱਗੇ ਨਾਲੋਂ ਕੰਮ ਹੋ ਰਿਹਾ ਤੇ ਟੂਰਿਜ਼ਮ ਲਈ ਵੀ ਹੁਣ ਆਪਣੇ ਬਹੁਤ ਟੂਰਿਸਟ ਪੰਜਾਬ ਆਉਂਦੇ ਹਨ ਹੋਰ ਹੋਰ ਹੋਰਨਾਂ ਸਟੇਟਾਂ ਚੋਂ ਪੰਜਾਬ ਘੁੰਮਣ ਆਉਂਦੇ ਹਨਾ ਪੰਜਾਬ ਵਿੱਚ ਬਹੁਤ ਸਾਰੀਆਂ ਅਜਿਹੀਆਂ ਥਾਵਾਂ ਜਿੱਥੇ ਲੋਕ ਬਾਹਰੋਂ ਘੁੰਮਣ ਆਉਂਦੇ ਹਨ ਧੰਨਵਾਦ ਜੀ